ਭਾਰਤ ਇੱਕ ਬਹੁਤ ਵੱਡਾ ਦੇਸ਼ ਹੈ ਇੱਥੇ ਹਰ ਤਰ੍ਹਾਂ ਦੀ ਨਾਚ ਸ਼ੈਲੀ ਮੌਜੂਦ ਹੈ ਪੰਜਾ ਜਿਵੇਂ ਕਿ ਪੰਜਾਬ ਵਿੱਚ ਗਿੱਧਾ ਭੰਗੜਾ ਮਸ਼ਹੂਰ ਹੈ ਬੌਮਬੇ ਸਾਇਡ ਹੀਪੋਪ ਵੱਲ ਲੋਕ ਜ਼ਿਆਦਾ ਰੁਚੀ ਰੱਖਦੇ ਹਨ ਕਰਨਾਟਕਾ ਵਿੱਚ ਕਥਕ ਕਲੀ ਚੱਲਦਾ ਹੈ ਕਥਕ ਕਲੀ ਚੱਲਦਾ ਹੈ ਆਂਧਰਾ ਪ੍ਰਦੇ ਕੁੱਛੀਪੁੜੀ ਮਸ਼ਹੂਰ ਹੈ ਭ ਭ ਭੰਗੜੇ ਵਿੱਚ ਬੋਲ਼ੀਆਂ ਪਾਈਆਂ ਜਾਂਦੀਆਂ ਹਨ ਗਿੱਧੇ ਗਿੱਧਾ ਪਾਇਆ ਜਾਂਦਾ ਹੈ ਪੰਮੀ ਬਾਈ ਸ ਇਹ ਪੰਜਾਬ ਦਾ ਇੱਕ ਬਹੁਤ ਹੀ ਮਸ਼ਹੂਰ ਡਾਂਸਰ ਹੈ ਅਤੇ ਗਾਇਕ ਵੀ ਹੈ